ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਅਸੀਂ ਨਾ ਇੱਧਰੋਂ ਆਏ ਸੀਗੇ ਫਤਿਹਗੜ੍ਹ ਸਾਹਿਬ ਕੰਨੀ ਓ ਪਟਿਆਲੇ ਵਿੱਚ ਅਤੇ ਮੇਰੀ ਫਰੈਂਡ ਨੇ ਨਾ ਤੁਹਾਡਾ ਨੰਬਰ ਦਿੱਤਾ ਸੀਗਾ ਕਿ ਉਹ ਕਹਿ ਰਹੇ ਸੀਗੇ ਮਤਲਬ ਵੀ ਤੁਹਾਨੂੰ ਅ ਬਾਜ਼ਾਰ ਵਗੈਰਾ ਜ਼ਿਆਦਾ ਘੁੰਮਦੇ ਹੋ ਅਤੇ ਮੈਮ ਸਾਡੇ ਨਾ ਵਿਆਹ ਕਰਕੇ ਮੈਂ ਫੁਲਕਾਰੀ ਵਗੈਰਾ ਅਤੇ ਪੰਜਾਬੀ ਜੁੱਤੀ ਲੈਣੀ ਸੀਗੀ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਰੇ ਸਭ ਤੋਂ ਜ਼ਿਆਦਾ ਵਧੀਆ ਬਾਜ਼ਾਰ ਕਿਹੜਾ ਮਤਲਬ ਕਿੱਥੋਂ ਜ਼ਿਆਦਾ ਸਸਤਾ ਰੇਟ ਪਏਗਾ ਦੱਸ ਸਕਦੇ ਹੋ ਵੀ ਕਿੱ ਕਿਹੜੇ ਬਾਜ਼ਾਰ ਜਾਈਏ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਅੱਛਾ ਜੀ ਫੁਲਕਾਰੀ ਵਗੈ ਫੁਲਕਾਰੀ ਵਗੈਰਾ ਨਾ ਵੈਸੇ ਉਹ ਆਪਣੇ ਸ਼ੌਪ 'ਤੇ ਹੀ ਕੱ ਕੱਢਦੇ ਆ ਜਾਂ ਕਿੱਦਾਂ ਅੱਛਾ ਜੀ ਨਹੀਂ ਮਤਲਬ ਸਭ ਤੋਂ ਜ਼ਿਆਦਾ ਵਧੀਆ ਅਦਾਲਤ ਬਾਜ਼ਾਰ ਅਤੇ ਆਹ ਨੇ ਹੈ ਨਾ ਜੀ

ਅੱਛਾ ਜੀ ਓਕੇ ਥੈਂਕ ਯੂ ਮੈਮ ਤੁਹਾਡਾ ਧੰਨਵਾਦ ਜੀ ਤੁਸੀਂ ਸਾਨੂੰ ਦੱਸਿਆ ਹਾਂਜੀ ਥੈਂਕ ਯੂ ਮੈਮ